ਸਾਡੇ ਜ਼ਿਲ੍ਹੇ ਵਿੱਚ ਕਈ ਜਗ੍ਹਾ ਕਈ ਥਾਵਾਂ ਹਨ ਘੁੰਮਣ ਲਈ ਜਿਹਨਾਂ ਵਿੱਚੋਂ ਪ੍ਰਮੁੱਖ ਥਾਵਾਂ ਰੌਕ ਗਾਰਡਨ ਰੋਜ਼ ਗਾਰਡਨ ਸੁਖਨਾ ਲੇਕ ਐਲਾਂਟੇ ਮਾਲ ਅਤੇ ਜੇ ਮੈਂ ਗੁਰਦੁਆਰਿਆਂ ਦੀ ਗੱਲ ਕਰਾਂ ਤਾਂ ਨਾਢਾ ਸਾਹਿਬ ਅੰਬ ਸਾਹਿਬ ਕਈ ਧਾਰਮਿਕ ਗੁਰਦੁਆਰੇ ਹਨ ਜਿਸ ਨਾਲ਼ ਗੁਰੂਆਂ ਦੀ ਹਿਸਟਰੀ ਜੁੜੀ ਹੋਈ ਹੈ ਜੇ ਮੈਂ ਰੋਜ਼ ਗਾਰਡਨ ਦੀ ਗੱਲ ਕਰਾਂ ਤਾਂ ਇੱਥੇ ਲੋਕ ਪਿਕਨਿਕ ਕਰਨ ਆਉਂਦੇ ਹਨ ਅਤੇ ਇੱਥੇ ਕਈ ਵਰਾਇਟੀਆਂ ਹੁੰਦੀਆਂ ਹਨ ਗੁਲਾਬਾਂ ਦੀਆਂ ਸਪੈਸ਼ਲੀ ਇੱਥੇ ਰੋਜ਼ ਫੈਸਟੀਵਲ ਵੀ ਮਨਾਇਆ ਜਾਂਦਾ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਗੁਲਾਬਾਂ ਨੂੰ ਇੱਥੇ ਦਰਸਾਇਆ ਜਾਂਦਾ ਹੈ ਜੇ ਮੈਂ ਰੌਕ ਗਾਰਡਨ ਦੀ ਗੱਲ ਕਰਾਂ ਰੌਕ ਗਾਰਡਨ ਬੇਸਿਕਲੀ ਡਾਕਟਰ ਨੇਕ ਚੰਦ ਜੀ ਨੇ ਬਣਵਾਇਆ ਹੈ ਜਿਸ ਵਿੱਚ ਸਾਰੇ ਵੇਸਟ ਮੈਟੀਰੀਅਲ ਨਾਲ਼ ਉਹਨਾਂ ਨੇ ਮੂਰਤੀਆਂ ਨੂੰ ਉੱਥੇ ਪੇਸ਼ ਕੀਤਾ ਹੈ ਅਤੇ ਨਾਲ਼ ਹੀ ਸੁਖਨਾ ਲੇਕ ਇੱਕ ਪ੍ਰਮੁੱਖ ਜਗ੍ਹਾ ਹੈ ਇੱਥੇ ਟੂਰਿਜ਼ਮ ਲਈ ਇੱਥੇ ਲੋਕ ਆਪਣੇ ਪਰਿਵਾਰ ਪਰਿਵਾਰਾਂ ਨਾਲ ਬੋਟਿੰਗ ਕਰਦੇ ਹਨ ਅਤੇ ਖਾਣ ਪੀਣ ਦਾ ਆਨੰਦ ਮਾਣਦੇ ਹਨ ਅਤੇ ਚੰਡੀਗੜ੍ਹ ਵਿੱਚ ਬਹੁਤ ਫੇਮੱਸ ਮਾਲ ਵੀ ਹੈ ਜਿਸਦਾ ਨਾਮ ਐਲਾਂਟੇ ਮਾਲ ਹੈ ਜਿਸ ਵਿੱਚ ਕਈ ਬ੍ਰਾਂਡ ਹਨ ਜਿੱਥੇ ਜਾ ਕੇ ਲੋਕ ਸ਼ੋਪਿੰਗ ਕਰਦੇ ਹਨ ਅਤੇ ਉੱਥੇ ਇੱਕ ਗੇਮਸ ਜ਼ੋਨ ਵੀ ਹੈ ਜਿਸ ਵਿੱਚ ਲੋਕ ਬੋਲਿੰਗ ਵਗੈਰਾ ਵੀ ਕਰ ਸਕਦੇ ਹਨ ਅਤੇ ਉੱਥੇ ਹੀ ਇੱਕ ਫਲੋਰ ਖਾਣ ਪੀਣ ਦਾ ਹੈ ਜਿੱਥੇ ਕਈ ਬ੍ਰਾਂਡਸ ਹਨ ਜਿੱਦਾਂ ਮੈੱਕਡੀ ਬਰਗਰ ਕਿੰਗ ਐਕਸੈਟਰਾ